ਮੇਰਾ ਮਨਪਸੰਦ ਮੌਸਮ ਬਸੰਤ ਰੁੱਤ ਹੈ ਬਸੰਤ ਰੁੱਤ ਭਾਰਤ ਵਿੱਚ ਫਰਵਰੀ ਤੋਂ ਅਪ੍ਰੈਲ ਮਹੀਨੇ ਤੱਕ ਚਲਦੀ ਹੈ ਇਹ ਰੁੱਤ ਬਹੁਤ ਸੁਹਾਵਣੀ ਹੁੰਦੀ ਹੈ ਕਿਉਂਕਿ ਇਸ ਰੁੱਤ ਵਿੱਚ ਫਲ ਫਲ ਫੁੱਲਦਾਰ ਬੂਟੇ ਹਰੇ ਭਰੇ ਹੋ ਜਾਂਦੇ ਹਨ ਖੇਤਾਂ ਵਿੱਚ ਹਰਿਆਲੀ ਆ ਜਾਂਦੀ ਹੈ ਫਸਲਾਂ ਵੀ ਆਪਣੇ ਜੋਬਨ 'ਤੇ ਹੁੰਦੀਆਂ ਹਨ ਸਰਸੋਂ ਦੇ ਪੀਲੇ ਪੀਲੇ ਫੁੱਲ ਮਨ ਨੂੰ ਬਹੁਤ ਹੀ ਸ਼ਾਨਦਾਰ ਦ੍ਰਿਸ਼ ਪੈਦਾ ਕਰਦੇ ਹਨ ਆਲਾ ਦੁਆਲਾ ਮਹਿਕ ਉੱਠਦਾ ਹੈ ਇਹ ਰੁੱਤ ਠੰਡੀ ਮਿੱਠੀ ਰੁੱਤ ਹੈ ਠੰਡ ਦਾ ਮੌਸਮ ਖਤਮ ਹੋਣ ਵਾਲਾ ਹੁੰਦਾ ਹੈ ਕਿਉਂਕਿ ਪੰਜਾਬ ਵਿੱਚ ਅਕਸਰ ਕਿਹਾ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ